ਮੈਂ ਸ਼ਹਿਰ ਵਿੱਚ ਰਹਿੰਦੀ ਹਾਂ ਅਤੇ ਮੇਰੇ ਬਾਕੀ ਘਰ ਦੇ ਸਦੱਸਿਆ ਪਿੰਡ ਵਿੱਚ ਰਹਿੰਦੇ ਹਨ ਮੇਰੇ ਪਿੰਡ ਦਾ ਨਾਮ ਰੋਣੀ ਪਿੰਡ ਹੈ ਕੋਲਜ ਨਜ਼ਦੀਕ ਹੋਣ ਕਾਰਨ ਸਾਨੂੰ ਸ਼ਹਿਰ ਵਿੱਚ ਰਹਿਣਾ ਪੈਂਦਾ ਹੈ ਪਰ ਜਦੋਂ ਕੋਲਜ਼ 'ਚ ਛੁੱਟੀਆਂ ਹੁੰਦੀਆਂ ਹਨ ਤਾਂ ਮੈਂ ਪਿੰਡ ਘੁੰਮਣ ਜਾਂਦੀ ਹਾਂ ਜਿੱਥੇ ਮੇਰੇ ਚਾਚਾ ਚਾਚੀ ਰਹਿੰਦੇ ਹਨ ਪਿੰਡ ਦੇ ਮੁਕਾਬਲੇ ਕੋਈ ਵੀ ਕੁਛ ਨਹੀਂ ਹੈ ਪਿੰਡ ਬਹੁਤ ਹੀ ਅੱਛਾ ਬਹੁਤ ਹੀ ਵਾਤਾਵਰਨ ਉਸ ਦਾ ਅੱਛਾ ਹੈ ਖੇਤਾਂ ਵਿੱਚ ਘੁੰਮਣਾ ਮੈਨੂੰ ਬਹੁਤ ਪਸੰਦ ਹੈ ਅਤੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕਾਂ ਨਾਲੋਂ ਵਧੇਰੇ ਚੰਗੇ ਹਨ ਅਤੇ ਬਹੁਤ ਪਿਆਰ ਕਰਦੇ ਹਨ